ਈਦ ਦਾ ਚੰਦ ਹੋਣਾ ਖੂਹ ਦੀ ਮਿੱਟੀ ਖੂਹ ਨੂੰ ਲੱਗਣਾ ਇੱਕ ਅੱਖ ਨਾਲ ਦੇਖਣਾ ਚਾਂਦੀ ਦੀ ਜੁੱਤੀ ਮਾਰਨਾ ਡੰਡੇ ਅੱਗੇ ਤਾਂ ਭੂਤ ਵੀ ਨੱਚਦੇ ਨੇ ਭੇਡਾਂ ਨੂੰ ਜ਼ੁਕਾਮ ਹੋਣਾ ਸੋ ਸੁਨਿਆਰ ਦੀ ਅਤੇ ਇੱਕ ਲੁਹਾਰ ਦੀ ਤੇਲੀ ਵੀ ਕੀਤਾ ਅਤੇ ਰੁੱਖਾ ਵੀ ਖਾਧਾ ਸੁੱਤੀਆਂ ਕਲਾ ਜਗਾਉਣੀਆਂ ਗੌਂ ਭੁੰਨਾਵੇ ਜੌਂ ਸੱਤੀ ਕੱਪੜੇ ਅੱਗ ਲੱਗਣਾ ਡਿੱਗਿਆ ਖੋਤੇ ਤੋਂ ਅਤੇ ਗੁੱਸਾ ਘੁਮਿਆਰ 'ਤੇ ਉਹ ਦਿਨ ਡੁੱਬਾ ਜਦ ਘੋੜੀ ਚੜ੍ਹਿਆ ਕੁੱਬਾ ਸੌ ਹੱਥ ਰੱਸਾ ਸਿਰੇ 'ਤੇ ਗੰਢ